ਦੇਖੋ ਕੰਮ ਵਾਲੇ ਥਾਂ ਜਿੱਥੇ ਅਸੀਂ ਕੰਮ ਕਰਨਾ ਉੱਥੇ ਸਾਨੂੰ ਬਹੁਤ ਸਾਰੇ ਵਿਵਾਦ ਵੀ ਹੁੰਦੇ ਹਨ ਐਨੀਆਂ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹਨ ਕਿ ਕਈ ਵਾਰੀ ਸਾਡਾ ਨਜਿੱਠਣਾ ਹੀ ਮੁਸ਼ਕਲ ਹੋ ਜਾਂਦਾ ਹੈ ਕੰਮ ਵਾਲੀ ਥਾਂ 'ਤੇ ਤਾਂ ਕਈ ਵਾਰੀ ਅਸੀਂ ਕਈ ਸਾਨੂੰ ਜਿਹੜਾ ਸਾਨੂੰ ਕੋਈ ਅਗਰ ਕੁਛ ਫਾਲਤੂ ਬੋਲੇ ਜਾਂ ਕਈ ਸਾਨੂੰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਨੂੰ ਕੋਈ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਸਾਨੂੰ ਚੁੱਪ ਹੋ ਜਾਣਾ ਚਾਹੀਦਾ ਮੈਂ ਤਾਂ ਵੈਸੇ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਕਿ ਮੈਂ ਕਿਸੇ ਨੂੰ ਜਵਾਬ ਦੇਵਾਂ ਹੀ ਨਾ ਜਿਹਦੇ ਨਾਲ ਕਿ ਅਗਲਾ ਥੋੜ੍ਹਾ ਆਪਣੇ ਆਪ ਨੂੰ ਹੀ ਸ਼ਰਮਿੰਦਗੀ ਮਹਿਸੂਸ ਕਰੇ ਕਿ ਮੈਂ ਹੀ ਬੋਲੀ ਜਾਂਦਾ ਵਾ ਤਾਂ ਅਗਲਾ ਤਾਂ ਮੈਨੂੰ ਕੋਈ ਜਵਾਬ ਹੀ ਨਹੀਂ ਦਿੰਦਾ ਅਤੇ ਕਈ ਵਾਰ ਮੈਂ ਉਹਨਾਂ ਦੀ ਹਾਂ 'ਚ ਹਾਂ ਵੀ ਸਾਨੂੰ ਵੈਸੇ ਮਿਲਾਉਣੀ ਪੈਂਦੀ ਹੈ ਕਈ ਵਾਰੀ ਉਹਨਾਂ ਦੇ ਨਾਲ ਸਾਨੂੰ ਕੋਂਪ੍ਰੋਮਾਈਜ਼ ਵੀ ਕਰਨਾ ਪੈਂਦਾ ਹੈ ਤਾਂ ਕਿ ਅਸੀਂ ਵੀ ਉਹੀ ਦੇਖੋ ਉਹਨਾਂ ਨੇ ਵੀ ਉਹੀ ਜਗ੍ਹਾ 'ਤੇ ਕੰਮ ਕਰਨਾ ਅਸੀਂ ਵੀ ਉਹੀ ਜਗ੍ਹਾ 'ਤੇ ਕੰਮ ਕਰਨਾ ਕਰਨਾ ਤਾਂ ਫਿਰ ਕੰਮ ਇਕੱਠੇ ਹੀ ਹੈ ਪਰ ਇਹ ਹੈ ਕਿ ਥੋੜ੍ਹੀ ਬਹੁਤ ਮੁਸ਼ਕਲ ਹੋ ਜਾਂਦੀ ਕਈ ਵਾਰੀ ਸਿਰ ਤੋਂ ਪਾਣੀ ਵੀ ਨਿਕਲ ਜਾਂਦਾ ਸਿਰ ਦੇ ਉੱਤੋਂ ਤਾਂ ਅਸੀਂ ਇਹੀ ਚਾਹੁੰਦੇ ਮੈਨੂੰ ਤਾਂ ਇਹੀ ਹੁੰਦਾ ਕਿ ਮੈਂ ਕਿਸੇ ਨੂੰ ਬਹੁਤਾ ਫਾਲਤੂ ਬੋਲਾਂ ਹੀ ਨਾ ਨਾ ਮੈਂ ਕਿਸੇ ਨੂੰ ਫਾਲਤੂ ਬੋਲਾਂ ਨਾ ਮੈਂ ਕਿਸੇ ਨੂੰ ਕੁਛ ਕਰਾਂ ਆਪਣੇ ਕੰਮ 'ਤੇ ਜਾਉ ਆਪਣਾ ਕੰਮ ਤੋਂ ਆਉ ਉਹੀ ਆਪਣਾ ਕੰਮ ਕਰਨ ਅਸੀਂ ਵੀ ਆਪਣਾ ਕੰਮ ਕਰੀਏ ਅਤੇ ਬਟ ਇਹ ਹੈ ਕਿ ਜੇ ਮੈਨੂੰ ਸਮਝਣਾ ਚਾਹੀਦਾ ਤਾਂ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਅਗਲੇ ਨੂੰ ਵੀ ਇਸ ਕਰਕੇ ਸਾਨੂੰ ਕਈ ਕਰੀ ਵਾਰੀ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਮੁਸ਼ਕਲਾਂ ਦੇ ਵਿੱਚ ਇਹ ਹੁੰਦਾ ਕਿ ਮੈਂ ਆਪਣਾ ਨਜਿੱਠ ਤਾਂ ਲੈਂਦੀ ਹਾਂ ਪਰ ਅੰਦਰ ਹੀ ਅੰਦਰ ਕਈ ਵਾਰ ਮੈਨੂੰ ਮੁਸ਼ਕਲ ਵੀ ਹੁੰਦੀ ਹੈ ਬਹੁਤ ਜ਼ਿਆਦੀ ਪਰ ਇਹ ਹੈ ਕਿ ਉਹ ਵੀ ਨਾ ਜਵਾਬ ਦੇਣ ਅਸੀਂ ਵੀ ਨਾ ਜਵਾਬ ਦੇਈਏ